ਅਤੇ ਮੈਨੂੰ ਸਿਰਫ ਦੋ ਐਪਸ ਹੀ ਜ਼ਿਆਦਾ ਵਧੀਆ ਲੱਗਦੀਆਂ ਨੇ ਇੱਕ ਤਾਂ ਫੇਸਬੁਕ ਦੂਸਰੀ ਹੈ ਇੰਸਟਰਾਗ੍ਰਾਮ ਫੇਸਬੁਕ ਦੇ ਉਪਰ ਮੈਨੂੰ ਕਾਫੀ ਜ਼ਿਆਦਾ ਨੌਲੇਜ ਮਿਲਦੀ ਹੈ ਅਬਾਊਟ ਮਾਈ ਸਬਜੈਕਟਸ ਜਿਵੇਂ ਕਿ ਮੈਨੂੰ ਇੰਗਲਿਸ਼ ਸਪੀਕਿੰਗ ਜਿਹੜਾ ਕਰ ਰਿਹਾ ਹੈਗਾ ਜਾਂ ਇੰਗਲਿਸ਼ ਬਾਰੇ ਸਿਖਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਮੈਂ ਇੱਦਾਂ ਦੇ ਪੇਜ ਲਾਈਕ ਕੀਤੇ ਹੋਏ ਨੇ ਜਿਹਦੇ ਵਿੱਚ ਮੈਨੂੰ ਨਵੇਂ ਨਵੇਂ ਸ਼ਬਦ ਓਹਦੇ ਵਿੱਚ ਗੱਲਬਾਤ ਕਰਨ ਦਾ ਢੰਗ ਜਿਹੜਾ ਕਿਵੇਂ ਹੈਗਾ ਉਹ ਸਾਰੀਆਂ ਚੀਜ਼ਾਂ ਮੈਂ ਉੱਥੋਂ ਸਿੱਖ ਰਿਹਾ ਹੈਗਾ ਇਮੇਂ ਕਿ ਇੰਸਟਾਗ੍ਰਾਮ ਇੰਸਟਾਗ੍ਰਾਮ ਦੇ ਮੇਰੇ ਪੇਜਸ ਉਹੀ ਲਾਇਕ ਹੈ ਜਿਹਨਾਂ ਤੋਂ ਮੈਨੂੰ ਕੁਝ ਸਿੱਖਣ ਨੂੰ ਮਿਲੇ ਇੰਸਟਾਗਰਾਮ ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਹੈਗੀਆਂ ਫੋਰਨਰ ਵੀਡੀਓਜ਼ ਆਉਂਦੀਆਂ ਉਹਨਾਂ ਨੂੰ ਦਾ ਮੈਨੂੰ ਜਿਹੜਾ ਢੰਗ ਆ ਉਹ ਪਤਾ ਲੱਗਦਾ ਵੀ ਆਪਣਾ ਜਿਹੜਾ ਬ੍ਰਿਟਿਸ਼ ਦੇ ਵਿੱਚ ਆਪਾਂ ਇਹਨੂੰ ਕਿੱਦਾਂ ਅਨਾਊਂਸ ਕਰਦੇ ਹੈਗੇ ਆਂ ਮੈਂ ਅਮੈਰੀਕਨ ਦੇ ਵਿੱਚ ਕਿੱਦਾਂ ਪ੍ਰੋਨਾਉਂਸ ਕਰਦੇ ਹਾਂ ਇਸ ਨਵੇਂ ਨਵੇਂ ਸ਼ਬਦ ਦੇਅਰ ਆਰ ਮੈਨੀ ਸ ਵਰਡਸ ਫਾਰ ਵੱਨ ਵਰਡ ਲਾਈ ਲਾਈਕ ਦੇਖ ਗੁਡ ਮੋਰਨਿੰਗ ਅਸੀਂ ਹੋਰ ਕਿੱਦਾਂ ਕਹਿ ਸਕਦੇ ਹਾਂ ਥੈਂਕ ਯੂ ਨੂੰ ਅਸੀਂ ਕਿੱਦਾਂ ਕਹਿ ਸਕਦੇ ਹਾਂ ਜਾਂ ਇਨਸਟਾਗਰਾਮ ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਇੱਦਾਂ ਵੀ ਨੇ ਜਿਹਨਾਂ ਤੋਂ ਮੈਨੂੰ ਜਿਹੜੇ ਨਵੇ ਨਵੇ ਸ਼ਬਦ ਸਿੱਖਣ ਨੂੰ ਮਿਲਦੇ ਹਨ